ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਅਤੇ ਇਹ ਸ਼ੌਂਕ ਮੈਨੂੰ ਅੰਦਰੋਂ ਅੰਦਰੂਨੀ ਖੁਸ਼ੀ ਪ੍ਰਦਾਨ ਕਰਦਾ ਹੈ ਮੈਨੂੰ ਅਲੱਗ ਅਲੱਗ ਨਾਵਲਕਾਰਾਂ ਅਤੇ ਕਵੀਆਂ ਦੁਆਰਾ ਲਿਖੀਆਂ ਪੁਸਤਕਾਂ ਬਹੁਤ ਚੰਗੀਆਂ ਲੱਗਦੀਆਂ ਹਨ ਜੋ ਕਿ ਜੀਵਨ ਨੂੰ ਖੁਸ਼ੀ ਖੁਸ਼ੀ ਜਿਊਣ ਦਾ ਤਰੀਕਾ ਦੱਸਦੀਆਂ ਹਨ ਅਤੇ ਇਨ੍ਹਾਂ ਨਾਲ ਜੀ ਜ਼ਿੰਦਗੀ ਦੀ ਜੀਣ ਦਾ ਤਰੀਕਾ ਪਤਾ ਲੱਗਦਾ ਹੈ ਜੋ ਕਿ ਸਾਡੇ ਵਿੱਚ ਬਹੁਤ ਹੀ ਸਕਾਰਾਤਮਕ ਊਰਜਾ ਪੈਦਾ ਕਰਦੇ ਹੈ ਅਤੇ ਇੱਥੇ